ਨਹੀਂ ਇਹ ਵਾਲਾ ਜਿਹੜਾ ਤੁਸੀਂ ਕੁਸਚਨ ਕੀਤਾ ਹੈ ਕਦੇ ਅੰਨੇ ਜਾਂ ਉੱਪਰਲੇ ਤੋਂ ਪੰਛੀ ਦੇਖਣ ਦੀ ਕੋਸ਼ਿਸ਼ ਮੈਂ ਨਹੀਂ ਕੀਤੀ ਇਹ ਦੇਖਣ ਦਾ ਮਤਲਬ ਮੈਨੂੰ ਇਹਦੇ ਬਾਰੇ ਕੋਈ ਤਜਰਬਾ ਨਹੀਂ ਹੈ ਨਾ ਹੀ ਮੈਂ ਕਦੀ ਇਹ ਵਾਲੀ ਗਤੀਵਿਧੀ ਨੂੰ ਕੀਤਾ ਆ ਨਾ ਹੀ ਮੈਂ ਕਦੇ ਇਸ ਤਰ੍ਹਾਂ ਦੇ ਪੰਛੀਆਂ ਨੂੰ ਦੇਖਿਆ ਆ